ਸਾਡੇ ਪੰਜਾਬ ਰਾਜ ਵਿੱਚ ਹਰ ਧਰਮਾਂ ਦੇ ਲੋਕ ਰਹਿੰਦੇ ਨੇ ਜਿਵੇਂ ਸਿੱਖ ਹਿੰਦੂ ਮੁਸਲਮਾਨ ਅਤੇ ਇਸਾਈ ਇਸ ਕਰਕੇ ਸਾਡੇ ਪੰਜਾਬ ਵਿੱਚ ਦਿਵਾਲੀ ਈਦ ਕ੍ਰਿਸਮਿਸ ਵਿਸਾਖ ਹਰ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਨੇ ਪਰ ਮੈਂ ਸਿੱਖ ਧਰਮ ਨਾਲ ਸੰਬੰਧਿਤ ਹੋਣ ਕਰਕੇ ਦਿਵਾਲੀ ਅਤੇ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦਾ ਹਾਂ ਦਿਵਾਲੀ ਤਾਂ ਸਾਡੇ ਘਰ ਵਿੱਚ ਸਾਰੇ ਹੀ ਪਰਿਵਾਰ ਵੱਲੋਂ ਗੁਰਬਾਣੀ ਪੜ੍ਹੀ ਜਾਂਦੀ ਹੈ ਅਤੇ ਰਾਤ ਵੇਲੇ ਦੀਪਕ ਘਿਓ ਦੇ ਦੀਪਕ ਜਲਾਏ ਜਾਂਦੇ ਨੇ ਅਤੇ ਵਿਸਾਖੀ 'ਤੇ ਸਾਡੇ ਗੁਰੂਆਂ ਨੇ ਖਾਲਸਾ ਪੰਥ ਸਾਜਿਆ ਸੀ ਇਸ ਕਰਕੇ ਅਸੀਂ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ ਗੁਰੂ ਘਰ ਜਾ ਕੇ ਮੱਥਾ ਟੇਕਦੇ ਹੋਏ ਆਪਣੇ ਗੁਰੂ ਨੂੰ ਯਾਦ ਕਰਦੇ ਹਾਂ